ਮੈਂ ਆਪਣੀ ਸ਼ਿਸਟਰ ਦੀ ਮੈਰਿਜ ਲਈ ਮੇਕਅੱਪ ਪ੍ਰੋਡਕਟ ਮਗਵਾਇਆ ਸੀ ਜੀ ਜਦ ਮੈਂ ਉਸਨੂੰ ਯੂਸ ਵਰ ਜਦੋ ਮੈਂ ਉਸਦੀ ਵਰਤੋਂ ਕੀਤੀ ਉਸ ਨਾਲ ਮੇਰੇ ਫ਼ੇਸ 'ਤੇ ਬਹੁਤ ਸਾਰੇ ਬਹੁਤ ਸਾਰੀ ਪਰੋਬਲਮਜ਼ ਹੋ ਗਈਆਂ ਫ਼ੇਸ ਬਹੁਤ ਖਰਾਬ ਹੋ ਗਿਆ ਸੀ ਇਸ ਕਰਕੇ ਮੈਂ ਇਹ ਸਲਾਹ ਦਉਗੀ ਕਿ ਔਨਲਾਈਨ ਪ੍ਰੋਡਕਟ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ